ਮੈਨੂੰ ਡਾਂਸ ਕਰਨਾ ਬਹੁਤ ਹੀ ਪਸੰਦ ਹੈ ਮੈਂ ਛੋਟੀ ਹੁੰਦੀ ਤੋਂ ਹੀ ਡਾਂਸ ਕਰਦੀ ਆਈ ਹਾਂ ਮੇਰੇ ਨਾਲ ਦੇ ਫਰੈਂਡਸ ਵੀ ਡਾਂਸ ਕਰਦੇ ਹਨ ਇੱਕ ਦਿਨ ਤਿਉਹਾਰ ਵਾਲੇ ਦਿਨ ਮੇਰੇ ਫਰੈਂਡਸ ਨੇ ਪਾਰਟੀਸਪੇਟਸ ਕੀਤਾ ਸੀ ਸਕੂਲ ਵਿੱਚ ਉੱਥੇ ਮੈਂ ਦੇਖਿਆ ਕਿ ਮੇਰੀ ਫਰੈਂਡਸ ਨੇ ਬਹੁਤ ਹੀ ਵਧੀਆ ਡਾਂਸ ਕੀਤਾ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਪਾਰਟੀਸਪੇਟ ਕਰਾਂ ਫਿਰ ਮੈਂ ਪਾਰਟੀਸਪੇਟ ਵਿੱਚ ਭਾਗ ਲਿਆ ਤਾਂ ਪਾਰਟੀਸਪੇਟ ਵਿੱਚ ਭਾਗ ਲਿਆ ਤਾਂ ਉੱਥੇ ਮੈਨੂੰ ਸਟੇਜ ਵਿੱਚ ਚੜ੍ਹਨ ਨੂੰ ਬਹੁਤ ਹੀ ਡਰ ਲੱਗਦਾ ਸੀ ਪਰ ਮੈਂ ਆਪਣੇ ਪੇਰੈਂਟਸ ਨੂੰ ਸਾਹਮਣੇ ਦੇਖ ਕੇ ਹੌਂਸਲਾ ਹੋ ਗਿਆ ਹੌਂਸਲਾ ਹੋ ਗਿਆ ਫਿਰ ਮੈਂ ਰੱਬ ਦਾ ਨਾਂ ਲੈ ਕੇ ਡਾਂਸ ਸ਼ੁਰੂ ਕਰ ਦਿੱਤਾ ਫਿਰ ਜਦੋਂ ਡਾਂਸ ਖਤਮ ਹੋਣ ਦੇ ਬਾਅਦ ਤਾੜੀਆਂ ਬਹੁਤ ਹੀ ਤੇਜ਼ ਵੱਜ ਰਹੀਆਂ ਸੀ ਅਤੇ ਮੈਂ ਹੈਰਾਨ ਹੋ ਗਈ ਕਿ ਮੈਂ ਇੰਨਾਂ ਵਧੀਆ ਡਾਂਸ ਕਰ ਲੈਂਦੀ ਹਾਂ ਫਿਰ ਮੈਨੂੰ ਮੇਰਾ ਇਨਾਮ ਅਨਾਊਂਸ ਕਰਨ ਲਈ ਮੈਂ ਫਸਟ ਪੁਜ਼ੀਸ਼ਨ ਆਈ ਮੇਰੀ ਫਿਰ ਮੇਰੀ ਫਸਟ ਪੁਜ਼ੀਸ਼ਨ ਆਈ ਫਿਰ ਮੈਂ ਹੈਰਾਨ ਹੋ ਗਈ ਕਿ ਮੈਂ ਇੰਨਾਂ ਵਧੀਆ ਡਾਂਸ ਕਰ ਲੈਂਦੀ ਹਾਂ ਫਿਰ ਮੇਰੀ ਫੋਟੋ ਅਖਬਾਰ ਵਿੱਚ ਵੀ ਆਈ ਮੈਂ ਅਖਬਾਰ ਵਿੱਚ ਫੋਟੋ ਆਈ ਨੂੰ ਕੱਟ ਕੇ ਆਪਣੇ ਘਰ ਦੀ ਦੀਵਾਰ ਉੱਤੇ ਟੰਗ ਲਈ ਫਿਰ ਮੈਨੂੰ ਉਸ ਫੋਟੋ ਨੂੰ ਦੇਖ ਕੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇੰਨਾਂ ਵਧੀਆ ਡਾਂਸ ਕਰ ਲੈਂਦੀ ਹਾਂ ਮੇਰੇ ਮਾਤਾ ਪਿਤਾ ਮੇਰੇ ਉੱਪਰ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ ਧੰਨਵਾਦ